ਹਰ ਇੱਕ ਖੇਤਰ ਵਿੱਚ ਉਦਯੋਗਿਕ ਵਿਕਾਸ ਲਈ ਜਗ੍ਹਾ ਤਾਂ ਹੈ ਪਰ ਉਹਨਾਂ ਨੂੰ ਲੱਭਣਾ ਜਿਹੜਾ ਉਹ ਬਹੁਤ ਹੀ ਮੁਸ਼ਕਿਲ ਹੈ ਪਰ ਜੇ ਇੱਕ ਵਾਰ ਅਸੀਂ ਉਸ ਨੂੰ ਆਪਣੇ ਤਰੀਕੇ ਨਾਲ ਆਪਣੀ ਸੋਚ ਨਾਲ ਆਪਣੇ ਸਮਾਜ ਨਾਲ ਜੋੜ ਕੇ ਉਸ ਦੇ ਵਿੱਚੋਂ ਕੁਛ ਵਧੀਆ ਢੰਗ ਨਾਲ ਜੋ ਸਮਾਜ ਨੂੰ ਜ਼ਰੂਰਤ ਹੈ ਆਪਣੇ ਖੇਤਰ ਵਿੱਚ ਉਸ ਨੂੰ ਦੇਖਦੇ ਹਾਂ ਤਾਂ ਉਸ ਨੂੰ ਦੇ ਵਿੱਚੋਂ ਅਸੀਂ ਇੱਕ ਅਜਿਹੇ ਚੀਜ਼ ਨੂੰ ਨਿਕਾਲ ਸਕਦੇ ਹਾਂ ਜਿਹੜੀ ਕਿ ਆਪਣੇ ਲਈ ਵੀ ਬ ਬੈਨੀਫਿਟ ਹੁੰਦੀ ਹੈ ਆਪਣੇ ਲਈ ਵੀ ਸਹੀ ਸਿੱਧ ਹੁੰਦੀ ਹੈ ਅਤੇ ਦੂਜਿਆਂ ਲਈ ਵੀ ਸਹੀ ਸਿੱਧ ਹੁੰਦੀ ਹੈ ਅਤੇ ਉਹਨੂੰ ਆਪਾਂ ਕਾਰੋਬਾਰ ਬਣਾ ਸਕਦੇ ਹਾਂ ਜਿਵੇਂ ਹੁਣ ਮੇਰੇ ਖੇਤਰ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਲੋਹੇ ਦੀਆਂ ਫੈਕਟਰੀਆਂ ਹਨ ਜਿਹਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਲੋਹੇ ਦਾ ਸਮਾਨ ਬਣਾਇਆ ਜਾਂਦਾ ਹੈ ਅਤੇ ਉਦਯੋਗਿਕ ਵਿਕਾਸ ਦੇ ਨਾਲ ਨਾਲ ਪ੍ਰਦੂਸ਼ਣ ਵੀ ਵੱਧ ਰਿਹਾ ਹੈ ਜਿੱਥੇ ਕਿ ਲੋਕਾਂ ਨੂੰ ਜ਼ਰੂਰੀ ਹੈ ਕਿ ਆਪਣਾ ਉਹ ਸਿਹਤ ਦਾ ਧਿਆਨ ਰੱਖਣ ਦਾ ਸਿਹਤ ਦਾ ਧਿਆਨ ਦੇ ਸੰਦਰਭ ਦੇ ਵਿੱਚ ਅਸੀਂ ਯੋਗਾ ਸੈਂਟਰ ਖੋਲ੍ਹ ਸਕਦੇ ਹਾਂ ਹੈਲਥ ਸੈਂਟਰ ਖੋਲ੍ਹ ਸਕਦੇ ਹਾਂ ਜਿੱਥੇ ਫਿ ਜਿਮ ਫਿਟਨੈਸ ਕਲੱਬ ਆ ਸਕਦੇ ਨੇ ਦੂਸਰਾ ਇਹ ਹੈ ਕਿ ਖਾਣੇ ਦੀ ਘਾਟ ਜੇ ਆਪਾਂ ਨੂੰ ਦਿਖ ਰਹੀ ਹੈ ਸਾਡੇ ਖੇਤਰ ਦੇ ਵਿੱਚ ਤਾਂ ਉੱਥੇ ਅਸੀਂ ਨਵੇਂ ਨਵੇਂ ਖਾਣੇ ਦੇ ਅਲੱਗ ਅਲੱਗ ਪ੍ਰਬੰਧ ਕਰਕੇ ਜਿਵੇਂ ਕਿ ਗ ਹ ਗਰਮੀਆਂ ਦੇ ਵਿੱਚ ਗੰਨੇ ਦਾ ਜੂਸ ਆ ਜਿਹੜਾ ਗੰਨੇ ਦੇ ਜੂਸ ਦੀਆਂ ਬਾਹਰ ਦੇ ਡਿਸਟਿਕਾਂ ਬਾਹਰ ਦੇ ਸਟੇਟਾਂ ਦੇ ਵਿੱਚੋਂ ਲੋਕ ਆ ਕੀ ਇੱਥੇ ਲਗਾਉਂਦੇ ਨੇ ਜੇ ਉਹ ਆਪਣੇ ਖੁਦ ਦੇ ਖੇਤਰ ਦੇ ਲੋਕ ਉੱਥੇ ਕਾਰੋਬਾਰ ਕਰਨ ਤਾਂ ਉਹਨਾਂ ਨੂੰ ਖੁਦ ਦਾ ਇਨਕਮ ਸੋਰਸ ਮਿਲੇਗਾ ਅਤੇ ਦੇਖਿਆ ਜਾਵੇ ਤਾਂ ਖੇਤੀਬਾੜੀ ਦੇ ਵਿੱਚ ਜੇ ਉਹ ਆਪਣਾ ਖੁਦ ਗੇਹੂੰ ਅਨਾਜ ਉਦਾ ਉਗਾਉਂਦੇ ਨੇ ਤਾਂ ਉਹਨਾਂ ਨੂੰ ਅ ਪੀਸ ਕੇ ਉਹਨਾਂ ਨੂੰ ਅੱਗੇ ਬਾਜ਼ਾਰ ਦੇ ਵਿੱਚ ਵੇਚਿਆ ਜਾ ਸਕਦਾ ਹੈ ਆਟੇ ਵਜੋਂ ਤਾਂ ਇੱਦਾਂ ਦੇ ਕੁਛ ਉਦਯੋਗਿਕ ਵਿਕਾਸ ਕਾਰਜ ਕੀਤੇ ਜਾ ਸਕਦੇ ਨੇ